ਸਾਡੀ ਰੋਜ਼ੀ ਰੋਟੀ ਬਿਜਲੀ 'ਤੇ ਬਹੁਤ ਡਿਪੈਂਡ ਕਰਦੀ ਹੈ ਕਿਉਂਕਿ ਅੱਜ ਕੱਲ੍ਹ ਬਿਜਲੀ ਦਾ ਬਹੁਤ ਮਹੱਤਵ ਹੈ ਅਤੇ ਜਿੰਨੇ ਵੀ ਅਪਲਾਈਸਿਸ ਹੈਗੇ ਨੇ ਉਹ ਸਾਰੇ ਬਿਜਲੀ ਨਾਲ ਹੀ ਚੱਲਦੇ ਹਨ ਫੈਕਟਰੀਆਂ ਵਿੱਚ ਵੀ ਬਿਜਲੀ ਦਾ ਬਹੁਤ ਮਹੱਤਵ ਹੈ ਜੇ ਬਿਜਲੀ ਬੰਦ ਹੋਵੇ ਤਾਂ ਮਜ਼ਦੂਰ ਵਿਹਲੇ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਪੇਮੈਂਟਾਂ ਨਹੀਂ ਮਿਲਦੀਆਂ ਜਿਨ੍ਹਾਂ ਕੋਲ ਇਨਵਾਟਰ ਹਨ ਉਹ ਤਾਂ ਬਿਜਲੀ ਬੰਦ ਹੋਣ 'ਤੇ ਚਲਾ ਲੈਂਦੇ ਹਨ ਅਤੇ ਉਹਨਾਂ ਦਾ ਕੰਮ ਚੱਲਦਾ ਰਹਿੰਦਾ ਹੈ ਅਤੇ ਉਹਨਾਂ ਦੀ ਪ੍ਰੋਡਕਸ਼ਨ ਨਹੀਂ ਰੁਕਦੀ ਪਰ ਜਿਹੜੇ ਛੋਟੇ ਆਪਣਾ ਇੰਡਸਟਰੀ ਵਾਲੇ ਹਨ ਉਹਨਾਂ ਕੋਲ ਵੱਡੇ ਇਨਵਾਟਰ ਖਰੀਦਣ ਦਾ ਖਰੀਦਣ ਜੋਗੇ ਨਹੀਂ ਹਨ ਅਤੇ ਉਹ ਇਸਦੇ ਪਿੱਛੋਂ ਬੜਾ ਪ੍ਰਭਾਵਿਤ ਹੁੰਦੇ ਹਨ ਬਿਜਲੀ ਦੇ ਕੱਟ ਇਸ ਲਈ ਬਹੁਤ ਨੁਕਸਾਨ ਕਰਦੇ ਹਨ